ਹਾਂਜੀ ਸਤਿ ਸ਼੍ਰੀ ਅਕਾਲ ਕੌਣ ਹਾਂਜੀ ਦੱਸੋ ਕੀ ਸੇਵਾ ਜੀ ਸਾਡੇ ਇਲਾਕੇ ਵਿੱਚ ਦੇਖਿਆ ਜਾਏ ਤਾਂ ਇੱਕ ਹਨੂੰਮਾਨ ਚੌਂਕ ਆ ਕਰਕੇ ਉੱਥੇ ਤੁਹਾਨੂੰ ਆਨੰਦ ਫਾਸਟ ਫੂਡ ਬੀਕਾਨੇਰ ਬੀ ਕੇ ਦੀ ਹੱਟੀ ਚਿਕਨ ਟਿੱਕਾ ਕੋਰਨਰ ਯੂਨੀਕ ਫਾਸਟ ਫੂਡ ਔਰ ਨਿਊ ਯੂਨੀਕ ਫਾਸਟ ਫੂਡ ਚੀਲਨ ਗ੍ਰਿਲਡ ਕਾਫੀ ਮਤਲਬ ਕਿ ਮਿਲ ਜਾਣਗੇ ਹਾਂ ਮਤਲਬ ਕਿ ਸਭ ਵਧੀਆ ਟੇਸਟ ਵੀ ਵਧੀਆ ਸਫਾਈ ਵੀ ਵਧੀਆ ਤਾਂ ਦੇਖੋ ਹੁਣ ਖਾਣ ਪੀਣ ਦੀ ਦੁਕਾਨ ਆ ਥੋੜ੍ਹਾ ਬਹੁਤਾ ਤਾਂ ਰੱਸ਼ ਪਿਆ ਹੀ ਰਹਿਣਾ ਨਾ ਹਾਂ ਜਗ੍ਹਾ ਵਧੀਆ ਸਫਾਈ ਪੂਰੀ ਵਧੀਆ ਸਟਾਫ ਵੀ ਇਕਦਮ ਪੂਰਾ ਫਰੈਂਡਲੀ ਇਹਨਾਂ ਦਾ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈ ਐ ਗਿਆਰਾਂ ਵਜੇ ਤੱਕ ਹੁੰਦੇ ਆ ਮਤਲਬ ਕਿ ਦੁਪਹਿਰ ਬਾਰਾਂ ਵਜੇ ਤੋਂ ਲੈ ਕੇ ਤਾਂ ਗੇ ਸ਼ਾ ਰਾਤੀਂ ਗਿਆਰਾਂ ਵਜੇ ਤੱਕ ਹੁੰਦਾ ਖੁੱਲ੍ਹੇ ਹੁੰਦੇ ਆ ਐਤਵਾਰ ਨੂੰ ਤਾਂ ਸਗੋਂ ਜ਼ਿਆਦਾ ਖੁੱਲ੍ਹੇ ਰਹਿੰਦੇ ਆ ਉਸ ਦਿਨ ਲੋਕੀ ਵੱਧ ਆਉਂਦੇ ਆ ਨਾ

ਬੱਸ ਉੱਥੇ ਚੱਲ ਜਾਓ ਤੁਹਾਨੂੰ ਹਰ ਗਲੀ 'ਚ ਕੋਈ ਨਾ ਕੋਈ ਦੁਕਾਨ ਲੱਭ ਜਾਣੀ ਵੈਸੇ ਮੇਨ ਇਹੀ ਕਿ ਬੀਕਾਨੇਰ ਚੱਲ ਜਾਓ ਅਨੰਦ ਫਾਸਟ ਫੂਡ ਅਤੇ ਯੂਨੀਕ ਫੂਡ ਅਤੇ ਇੱਕ ਚਿਕਨ ਟਿੱਕਾ ਕੋਰਨਰ ਚੱਲ ਜਾਓ ਨਹੀਂ ਸਾਡਾ ਯਾਰ ਫੋਨ ਹੀ ਦੂਜਾ ਬਟਨਾਂ ਵਾਲਾ ਕਿੱਥੋਂ ਵੇਖਣਾ ਅਸੀਂ ਯੂਟਿਊਬ ਠੀਕ ਹੈ ਠੀਕ ਹੈ ਓਕੇ ਬਾਏ